ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੈਂ ਕੰਪਨੀ ਤੋਂ ਬੋਲਦੀ ਹਾਂ ਅਸੀਂ ਮਤਲਬ ਤੁਹਾਡੇ ਪ੍ਰੋਡਕਟ ਦੀ ਡਿਟੇਲ ਦੇਖੀ ਸੀਗੀ ਤੁਸੀਂ ਡਿਟੇਲ 'ਚ ਦੱਸ ਸਕਦੇ ਹੋ ਕਿ ਹੋਰ ਮਤਲਬ ਸਾਡੇ ਕੋਲ ਗ ਔਰਗੈਨਿਕ ਚੀਜ਼ਾਂ ਹੋਣਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਸਰ ਹਾਂਜੀ ਸਰ ਠੀਕ ਹੈ ਸਰ ਅੱਛਾ ਸਰ ਸਾਨੂੰ ਤੋਂ ਜ਼ਿਆਦਾ ਹਨੀ ਦੀ ਲੋੜ ਹੈਗੀ ਅਸੀਂ ਕਿਉਂਕਿ ਬਿਸਕਿਟ ਦੇ ਵਿੱਚ ਫਿੱਲਿੰਗ ਕਰਨੀ ਆ ਹਨੀ ਦੀ ਅਤੇ ਫਿਰ ਉਹਦਾ ਪ੍ਰਾਈਜ ਵਗੈਰਾ ਕੀ ਹੋਵੇਗਾ ਉਹ ਸਾਨੂੰ ਦੱਸ ਦਿਓ ਹਾਂਜੀ ਓਕੇ ਸਰ ਠੀਕ ਹੈ ਸਰ ਇੰਨੇ ਨਾਲ ਤਾਂ ਸਰਜੂਗਾ ਸਾਡਾ ਅਤੇ ਕੀ ਕਹਿੰਦੇ ਆ ਪ੍ਰਾਈਸ ਠੀਕ ਹੈ ਮਸਤ ਹੈ ਜਿੰਨਾ ਸਾਨੂੰ ਚਾਹੀਦਾ ਉਨੇ ਉਨੇ ਦੀ ਅਕੋਰਡਿੰਗ ਸਹੀ ਹੈ ਤੁਹਾਡਾ ਪ੍ਰਾਈਜ ਅਤੇ ਸਰ ਹੋਰ ਮਤਲਬ ਜਿਵੇਂ ਬਲਕ ਦੇ ਵਿੱਚ ਸਮਾਨ ਲੈਣਾ ਹੋਵੇ ਤਾਂ ਤੁਹਾਡੀ ਸ਼ੋਪ 'ਤੇ ਆਉਣਾ ਪਵੇਗਾ ਕਿੱਦਾਂ ਕੀ ਪ੍ਰੋਸੈਸ ਹੁੰਦ ਹੁੰਦਾ ਸਰ ਠੀਕ ਹੈ ਸਰ ਅਤੇ ਤੁਸੀਂ ਮੇਰਾ ਨੰਬਰ ਇਸ 'ਤੇ ਨਾ ਵਟਸਅਪ ਚਲਦਾ ਅਤੇ ਤੁਸੀਂ ਆਪਣਾ ਐਡਰੈਸ ਵਗੈਰਾ ਜੋ ਵੀ ਆ ਸਭ ਆਪਣਾ ਦੇ ਦਿਓ ਠੀਕ ਹੈ ਸਰ ਜ਼ਰੂਰ ਜ਼ਰੂਰ ਇਸ ਦੇ ਨਾਲ ਆਪਾਂ ਅ ਕੋਸ਼ਿਸ਼ ਕਰਾਂਗੇ ਇਹ ਚੀਜ਼ਾਂ ਵੀ ਬਾਕੀ ਬਾਏ ਕਰੀਏ ਹਾਂਜੀ ਸਰ ਕੀ ਰੇਟ ਹੋਵੇਗਾ ਅੱਛਾ ਸਰ ਕੀ ਕਹਿੰਦੇ ਆਪਾਂ ਇੱਕ ਹੋਰ ਜਗ੍ਹਾ 'ਤੇ ਮਤਲਬ ਗੱਲ ਕੀਤੀ ਸੀਗੀ ਗੁੜ ਵਾਸਤੇ ਅਤੇ ਉਹ ਤਾਂ ਸਰ ਮਤਲਬ ਦੋ ਸੌ ਤਿੰਨ ਸੌ ਤੱਕ ਤਾਂ ਬੋਲ ਰਹੇ ਸੀ ਤੁਸੀਂ ਤਾਂ ਜ਼ਿਆਦਾ ਪ੍ਰਾਈਜ ਬੋਲ ਰਹੇ ਹੋ ਸਰ ਓਕੇ ਸਰ ਜਿਹੜਾ ਤੁਹਾਡਾ ਕੰਮ ਹੈਗਾ ਮਤਲਬ ਆਪਾਂ ਦੇਖ ਸਕਦੇ ਹਾਂ ਨਾ ਕਿਉਂਕਿ ਔਰਗੈਨਿਕ ਹੈ ਅਤੇ ਸਭ ਦੇ ਸਾਹਮਣੇ ਹੁੰਦਾ ਸਰ ਉਹਦਾ ਕੀ ਪ੍ਰਾਈਜ ਹੋਵੇਗਾ ਅੱਛਾ ਠੀਕ ਹੈ ਸਰ ਵਧੀਆ ਤੁਸੀਂ ਜਾਣਕਾਰੀ ਦਿੱਤੀ ਮੈਨੂੰ ਅੱਛਾ ਅੱਛਾ ਸਰ ਜੋ ਮੈਨੂੰ ਲੋੜ ਹੈਗੀ ਜ਼ਿਆਦਾ ਹਨੀ ਦੀ ਉਹ ਤੇ ਮੈਂ ਜ਼ਰੂਰ ਲਉਂਗੀ ਬਾਕੀ ਜੋ ਤੁਸੀਂ ਦੱਸਿਆ ਆਪਣੀ ਸੁਜੈਸਟ ਕੀਤੀਆਂ ਚੀਜ਼ਾਂ ਅਤੇ ਮੈਂ ਆਪਣੇ ਨਾਨ ਦੇ ਵਿੱਚ ਹੈਗੀਆਂ ਉਹਨਾਂ ਨੂੰ ਜ਼ਰੂਰ ਸੁਜੈਸਟ ਕਰੂੰਗੀ ਅਤੇ ਉਹ ਜ਼ਰੂਰ ਤੁਹਾਡੇ ਅ ਦੋ ਲੈਣਗੇ ਜੇ ਮੈਨੂੰ ਵਧੀਆ ਲੱਗਿਆ ਨਾ ਸਮਾਨ ਤਾਂ ਜ਼ਰੂਰ ਲੈਣਗੇ ਠੀਕ ਹੈ ਸਰ ਥੈਂਕ ਯੂ ਸਰ ਜਾਣਕਾਰੀ ਲਈ